ਪੁਰਾਣੇ ਟਾਈਮ ਵਿੱਚ ਕਿਸਾਨ ਦਾਲਾਂ ਮੂੰਗੀ ਛੋਲੇ ਸਰ੍ਹੋਂ ਅਤੇ ਸੂਰਜਮੁਖੀ ਆਦਿ ਸਭ ਘਰ ਹੀ ਉਗਾਉਂਦੇ ਨੇ ਔਰ ਅੱਜ ਦੇ ਟਾਈਮ ਵਿੱਚ ਕੋਈ ਵੀ ਮਿਹਨਤ ਕਰਕੇ ਰਾਜ਼ੀ ਨਹੀਂ ਹੈ ਸਭ ਕੋਈ ਬਜ਼ਾਰ ਤੋਂ ਹੀ ਸਮਾਨ ਲੈਂਦੇ ਹਨ ਕੋਈ ਵੀ ਖੇਤੀ ਕਰਕੇ ਦਾਲ ਸਬਜ਼ੀ ਔਰ ਸੂਰਜਮੁਖੀ ਵਗੈਰਾ ਨਹੀਂ ਉਗਾਉਂਦਾ ਹੁਣ ਤਾਂ ਰਵਾਇਤੀ ਖੇਤੀ ਵਿੱਚ ਕਣਕ ਜੀਰੀ ਆਦਿ ਹੀ ਰਹਿ ਗਏ ਨੇ ਪੁਰਾਣੇ ਟਾਈਮਾਂ ਵਿੱਚ ਹਰੇਕ ਚ ਆਈਟਮ ਘਰ ਤੋਂ ਹੀ ਪੈਦਾਵਾਰ ਹੋ ਜਾਂਦੀ ਸੀ ਔਰ ਅੱਜ ਦੇ ਟਾਈਮ ਵਿੱਚ ਹਰੇਕ ਚੀਜ਼ ਸਾਨੂੰ ਬਜ਼ਾਰ ਤੋਂ ਹੀ ਲੈਣੀ ਪੈਂਦੀ ਹੈ